ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਪਰ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਰੋਬੋਟਿਕਸ ਪੜੂੰਗੀ ਤਾਂ ਮੈਂ ਹੁਣ ਰੋਬੋਟਿਕਸ ਦੀ ਸਟੱਡੀ ਆਪਦੀ ਸ਼ੁਰੂ ਕੀਤੀ ਹੈ ਉਨਦੇ ਉੱਤੇ ਸਰਚ ਕਰਨੀ ਸ਼ੁਰੂ ਕੀਤੀ ਹੈ ਮੈਂ ਰੋਬੋਟਿਕਸ ਦੇ ਨਾਲ ਪੜ੍ਹਨ ਦੇ ਨਾਲ ਨਾਲ ਉਹਨੂੰ ਬਹੁਤ ਜ਼ਿਆਦਾ ਇੰਟਰਸਟ ਦੇ ਨਾਲ ਸਿੱਖਿਆ ਹੈ ਤਾਂ ਰੋਬੋਟਿਕਸ ਦੇ ਵਿੱਚ ਕੀ ਹੈ ਬਹੁਤ ਸਾਰੇ ਜੋ ਵੀ ਸਾਡੇ ਇਲੈਕਟਰੀਕਲ ਵਾਲੇ ਔਜਾਰ ਹੁੰਦੇ ਹਨ ਉਹਨਾਂ ਦੀ ਵਰਤੋਂ ਕਰਕੇ ਅਸੀਂ ਅਜਿਹੇ ਮੋਡਲ ਤਿਆਰ ਕਰਦੇ ਹਾਂ ਉਸ ਬੁੱਕ ਦੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਇਸ ਦੇ ਵਿੱਚ ਹੁਣ ਅੱਜ ਕੱਲ੍ਹ ਆਰਟੀਫਿਸ਼ਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦਾ ਵੀ ਯੂਜ ਕਰਕੇ ਅਸੀਂ ਰੋਬੋਟਿਕਸ ਦੇ ਨਵੇਂ ਨਵੇਂ ਮੋਡਲ ਤਿਆਰ ਕਰ ਰਹੇ ਹਾਂ ਨਵੇਂ ਨਵੇਂ ਮਾਡਲ ਤਿਆਰ ਕਰਨ ਦੇ ਨਾਲ ਨਾਲ ਉਹਨਾਂ ਦੀ ਵਰਤੋਂ ਹੁਣ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਹੋਣ ਲੱਗ ਗਈ ਹੈ ਤਾਂ ਉਸ ਬੁੱਕ ਦੇ ਵਿੱਚ ਬਹੁਤ ਕੁਛ ਅਜਿਹਾ ਲਿਖਿਆ ਸੀ ਕਿ ਜੋ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਅਤੇ ਮੈਂ ਪਹਿਲਾਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਰੋਬਰਟਿਕਸ ਦੇ ਉੱਤੇ ਸਰਚ ਕਰਾਂਗੀ ਹੁਣ ਮੈਂ ਉਸ ਕਿਤਾਬ ਨੂੰ ਪੜ੍ਹ ਕੇ ਅਜਿਹਾ ਸੋਚ ਰਹੀ ਹਾਂ ਕਿ ਮੈਂ ਖੁਦ ਬਹੁਤ ਸਾਰੀਆਂ ਰੋਬੋਟਿਕਸ ਦੀਆਂ ਕਿਤਾਬਾਂ ਪੜ੍ਹਾਂਗੀ ਅਤੇ ਮੈਨੂੰ ਇਸ ਤਰ੍ਹਾਂ ਵਧੀਆ ਲੱਗੀ ਹੈ ਕਿਉਂਕਿ ਉਸ ਦੇ ਵਿੱਚ ਨਵੇਂ ਨਵੇਂ ਤਰੀਕਿਆਂ ਦੇ ਨਾਲ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹਨ ਅਤੇ ਉਹ ਨਵੀਂ ਤਕਨੀਕ ਦੇ ਨਾਲ ਜੁੜੀ ਰਹਿਣ ਦੇ ਵਿੱਚ ਸਾਨੂੰ ਮਦਦ ਕਰ ਰਹੀ ਹੈ ਰੋਬੋਟਿਕਸ ਆਉਣ ਵਾਲੇ ਭਵਿੱਖ ਦਾ ਬਹੁਤ ਵੱਡਾ ਚੀਜ਼ ਹੈ